ਹਾਂਜੀ ਯੂਨੀਵਰਸਿਟੀ ਦੇ ਵਿੱਚ ਦਾਖਲੇ ਦੇ ਲਈ ਕਈ ਤਰ੍ਹਾਂ ਦੇ ਟੈਸਟ ਹੁੰਦੇ ਹਨ ਉਹ ਟੈਸਟ ਪਾਸ ਕਰਨ ਤੋਂ ਬਾਅਦ ਐਡਮਿਸ਼ਨਸ ਬੱਚਿਆਂ ਨੂੰ ਮਿਲਦੀ ਹੈ ਹਾਂ ਕਈ ਬੱਚੇ ਕੋਟੇ ਦੇ ਥਰੂ ਵੀ ਜਾਂਦੇ ਹਨ ਕਈਆਂ ਨ ਕਈਆਂ ਨ ਕਈ ਸਪੋਰਟਸ ਕੋਟੇ ਹੁੰਦੇ ਹਨ ਹੈ ਨਾ ਅਤੇ ਕਈ ਬੱਚਿਆਂ ਨੂੰ ਜਿਵੇਂ ਕਲਾਕਾਰੀ ਕਈ ਬੱਚੇ ਕਲਾਕਾਰੀ ਦੇ ਬੇਸ 'ਚ ਜਾਂਦੇ ਹਨ ਜਿਵੇਂ ਕਿ ਮੇਰੀ ਹੁਣ ਇੱਕ ਫਰੈਂਡ ਸੀ ਠੀਕ ਹੈ ਉਹ ਤਾਂ ਪੜ੍ਹਾਈ ਦੇ ਬੇਸ 'ਚ ਤਾਂ ਇੰਨੀ ਵਧੀਆ ਨਹੀਂ ਸੀ ਹਾਂ ਲੇਕਿਨ ਉਹ ਇੱਕ ਖਿਡਾਰੀ ਸੀ ਹੋਕੀ ਦੀ ਪਲੇਅਰ ਸੀ ਹੋਕੀ ਉਹ ਬਹੁਤ ਵਧੀਆ ਤਰੀਕੇ ਨਾਲ ਖੇਡਦੀ ਸੀ ਅਤੇ ਉਹਨੂੰ ਮਤਲਬ ਖੇਡ ਦੇ ਕੋਟੇ ਦੇ ਵਿੱਚ ਉਹਨਾਂ ਨੇ ਲਿਆ ਹੈ ਅਤੇ ਖੇਡ ਦੇ ਕੋਟੇ 'ਤੇ ਉਹਦੀ ਐਡਮਿਸ਼ਨ ਹੋ ਗਈ ਹੈ ਅੱਜ ਉਹ ਬੜੇ ਵਧੀਆ ਲੈਵਲ 'ਚ ਉਹ ਖੇਡ ਰਹੀ ਹੈ ਇਸ ਤਰੀਕੇ ਨਾਲ ਕਈ ਸਟੂਡੈਂਟ ਇਹੋ ਜਿਹੇ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਉਹ ਕੋਟੇ ਦੇ ਥਰੂ ਜਾਂਦੇ ਨੇ ਅਤੇ ਆਪਣੇ ਕੋਲੇਜ ਦਾ ਜਿਵੇਂ ਨਾਮ ਰੋਸ਼ਨ ਕਰਦੇ ਹਨ ਇਸ ਪ੍ਰਕਾਰ ਹੀ ਇਹ ਕੋਟੇ ਕਈ ਤਰ੍ਹਾਂ ਦੇ ਹੋ ਸਕਦੇ ਨੇ ਜਿਵੇਂ ਕਿ ਕੋਈ ਕਲਾ ਹੋਰ ਕਲਾਵਾਂ ਦੇ ਵੀ ਹੋ ਸਕਦੇ ਕੋਈ ਪੇਂਟਿੰਗ ਹੋ ਗਿਆ ਕੋਈ ਸਿਲਾਈ ਬੁਣਾਈ ਦਾ ਹੋ ਗਿਆ ਕੋਈ ਆਰਟ ਗ੍ਰਾਫ ਆਰਟ ਐਂਡ ਗਰਾਫਟ ਦਾ ਹੋ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਪੱਧਰ 'ਚ ਕਈ ਲੋਕ ਜਿਹੜੇ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਰਹੇ ਨੇ ਅਤੇ ਕਈ ਮਤਲਬ ਕਈ ਵ ਯੂਨੀਵਰਸਿਟੀਆਂ ਜੋ ਹੈ ਸਿਫਾਰਿਸ਼ ਵੀ ਚੱਲਦੀ ਹੈ ਕਈਆਂ 'ਚ ਅਤੇ ਕਈਆਂ 'ਚ ਦੇਖੋ ਪੈਸਾ ਵੀ ਚੱਲਦਾ ਹੈ ਠੀਕ ਹੈ ਪੈਸਾ ਜੋ ਹੈ ਇਨਸਾਨ ਦੇ ਵਿੱਚ ਇਨ ਬਹੁਤ ਹੀ ਮਾਇਨੇ ਰੱਖਦਾ ਹੈ ਕੋਈ ਇੱਕ ਦੋ ਸੀਟਾਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿਹੜੀਆਂ ਅਸੀਂ ਪੈਸੇ ਦੇ ਕੇ ਖ਼ਰੀਦ ਸਕਦੇ ਨੇ ਚਲੋ ਹਰ ਕੋਈ ਤਾਂ ਪੈਸਾ ਨਹੀਂ ਭਰ ਸਕਦਾ ਅਤੇ ਇਸ ਲਈ ਇਹ ਉਹ ਆਪਣੇ ਆਪ ਨੂੰ ਉਹ ਕਈ ਪੜ੍ਹਦੇ ਨੇ ਕਈ ਬੱਚੇ ਬਹੁਤ ਜ਼ਿਆਦਾ ਪੜ੍ਹ ਕੇ ਆਪਣੇ ਆਪ ਨੂੰ ਅੱਗੇ ਲੈ ਕੇ ਜਾਂਦੇ ਨੇ ਅਤੇ ਕਈ ਕਈਆਂ ਨੂੰ ਇੱਦਾਂ ਸਪੋਰਟਸ 'ਚ ਮਿਲ ਜਾਂਦੀ ਹੈ ਇਸ ਤਰ੍ਹਾਂ ਉਹਨਾਂ ਦੀ ਐਡਮਿਸ਼ਨ ਹੋ ਜਾਂਦੀ ਹੈ ਅਤੇ ਉਹ ਬੱਚੇ ਆਪਣੇ ਆਪ ਨੂੰ ਅੱਗੇ ਵਧਾ ਸਕਦੇ ਚਲੋ ਇਹ ਗੱਲ ਬਹੁਤ ਹੀ ਵਧੀਆ ਹੈ ਉਹਨਾਂ ਲੋਕਾਂ ਲਈ ਜਿਹੜੇ ਪੈਸੇ ਨਹੀਂ ਭਰ ਸਕਦੇ ਇਸ ਥਰੂ ਆਪਣੇ ਆਪ ਨੂੰ ਆਪਣੀ ਕਲਾਵਾਂ ਨੂੰ ਉਹ ਅੱਗੇ ਵਧਾ ਸਕਦੇ ਹਨ ਅਤੇ ਕੋਲਜ ਦਾ ਜਿਹੜਾ ਨਾਂ ਹੈ ਉਹ ਰੋਸ਼ਨ ਕਰ ਸਕਦੇ ਹਨ